ਕਵਿਤਾਵਾਂ ਦੇ ਵਿੱਚ ਕਲਾਤਮਕ ਪ੍ਰਗਟਾਵਿਆਂ ਦੇ ਵਿੱਚ ਅਸੀਂ ਪੰਜਾਬੀ ਭਾਸ਼ਾ ਦੀ ਜਿਹੜੀ ਹੈਗੀ ਹੈ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਜੋ ਪੰਜਾਬੀ ਦੀ ਭਾਸ਼ਾ ਨੂੰ ਅਸੀਂ ਕਵਿਤਾ ਦੇ ਰੂਪ ਵਿੱਚ ਪ੍ਰਗਟ ਕਰਾਂਗੇ ਤਾਂ ਪੰਜਾਬੀ ਦਾ ਵਧੀਆ ਜਿਹੜਾ ਪ੍ਰਤੱਖ ਜਿਹੜਾ ਸਾਨੂੰ ਹੈਗਾ ਉਹਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਨਜ਼ਰ ਆਏਗੀ ਧੰਨਵਾਦ